ਭਾਰਤ ਵਿੱਚ ਬੈਂਕਿੰਗ ਅਤੇ ਬੀਮਾ ਖੇਤਰ ਦਾ ਦੂਜੇ ਰਾਜਾਂ ਤੋਂ ਤੁਲਨਾ ਵਿੱਚ ਬਹੁਤ ਹੀ ਵਾਧਾ ਹੋਇਆ ਭਾਰਤ ਵਿੱਚ ਬੈਂ ਬੈਂਕਿੰਗ ਅਤੇ ਬੀਮਾ ਕੰਪਨੀਆਂ ਬਹੁਤ ਹਨ ਪੰਜਾਬ ਵਿੱਚ ਵੀ ਹੁਣ ਬੈਂਕ ਅਤੇ ਬੀਮਾ ਕੰਪਨੀਆਂ ਬਹੁਤ ਹੋ ਗਈਆਂ ਨੇ ਮੈਂ ਵੀ ਪੰਜਾਬ ਦੇ ਇੱਕ ਲੁਧਿਆਣੇ ਇਲਾਕੇ ਦੇ ਵਿੱਚ ਬੀਮਾ ਕੰਪਨੀ ਦੀ ਐਡਵਾਈਜ਼ਰ ਹਾਂ ਹੁਣ ਲੋਕੀ ਲੋਕਾਂ ਨੇ ਬਹੁਤ ਇਨਵਾਇਰਮੈਂਟ ਅਸਰ ਪੈ ਰਿਹਾ ਲੋਕਾਂ ਦੇ ਉੱਤੇ ਹੁਣ ਓਹ ਲੋਕੀ ਬੈਂਕਿੰਗ ਨਾਲੋਂ ਜਿਆਦਾ ਬੀਮਾ ਕੰਪਨੀ ਵਿੱਚ ਵੀ ਪੈਸਿਆਂ ਨੂੰ ਸੇਵਿੰਗ ਕਰਨ ਲੱਗ ਗਏ ਹਨ ਹੁਣ ਲੋਕਾਂ ਨੂੰ ਬਹੁਤ ਪਤਾ ਚੱਲ ਗਿਆ ਹੈ ਕਿ ਬੀਮਾ ਕਰਾਣ ਦੇ ਕੀ ਫਾਇਦੇ ਹਨ ਇੱਕ ਮੇਰੀ ਫਰੈਂਡ ਉਹਨੇ ਆਪਣੇ ਬੀਮਾ ਕੰਪਨੀ ਦੇ ਵਿੱਚ ਹੁੰਦੇ ਹੋਏ ਵੀ ਉਹਨੇ ਆਪਣੇ ਹਸਬੈਂਡ ਦਾ ਬੀਮਾ ਨਹੀਂ ਕਰਵਾਇਆ ਤੇ ਉਹਨੇ ਅਚਾਨਕ ਕੀ ਕਿਸੇ ਕਾਰਨ ਨਾਲ ਡੈਥ ਹੋ ਗਈ ਤੇ ਹੁਣ ਉਹ ਵਿਚਾਰੇ ਬਹੁਤ ਹੀ ਆਪਣੇ ਸਫਰ ਕਰ ਰਹੇ ਨੇ ਜ਼ਿੰਦਗੀ ਵਿੱਚ ਇਸ ਲਈ ਮੈਂ ਤਾਂ ਇਹੀ ਕਹਿੰਦੀ ਆ ਕਿ ਹਰ ਹਰ ਕੋਈ ਵਿਅਕਤੀ ਬੀਮਾ ਜਰੂਰ ਕਰਵਾਏ ਬੀਮੇ ਬੀਮੇ ਕਰਵਾਣ ਦੇ ਬਹੁਤ ਹੀ ਫਾਇਦੇ ਹਨ ਇੱਕ ਤਾਂ ਇਨਵੈਸਟਮੈਂਟ ਵਾਧਾ ਹੁੰਦਾ ਹੈ ਨਾ ਹੀ ਆਪਾਂ ਜਿਵੇਂ ਬੈਂਕਿੰਗ ਵਿੱਚ ਪੈਸੇ ਰੱਖਦੇ ਆ ਇਹਦੇ ਵਿੱਚ ਕਈ ਵਾਰੀ ਕਢਵਾ ਲੈਦੇ ਆ ਤੇ ਕਈ ਵਾਰੀ ਖਰਚ ਕਰ ਲੈਦੇ ਆ ਪਰ ਇਹਦੇ ਵਿੱਚ ਇਹ ਹੈ ਕਿ ਆਪਾਂ ਇਨਵੈਸਟਮੈਂਟ ਹੀ ਹੁੰਦੀ ਰਹੇਗੀ ਜਰੂਰ ਬੀਮਾ ਕਰਵਾਣਾ ਚਾਹੀਦਾ ਹੈ ਭਾਰਤ ਵਿੱਚ ਤੁਲਨਾ ਕੀਤੀ ਜਾਵੇ ਤਾਂ ਪੰਜਾਬ ਵਿੱਚ ਵੀ ਬਹੁਤ ਬੈਂਕਾਂ ਦਾ ਵਾਧਾ ਹੋ ਗਿਆ ਜਿਵੇਂ ਐਸਬੀਆਈ ਹੋ ਗਿਆ ਆਈਸੀਆਈਸੀ ਬੈਂਕ ਐ ਪੰਜਾਬ ਐਂਡ ਸਥਿਤ ਬੈਂਕ ਐ ਪੰਜਾਬ ਨੈਸ਼ਨਲ ਬੈਂਕ ਐ ਇਹਨਾਂ ਵਿੱਚ ਵੀ ਇਨਸ਼ੋਰੈਂਸ ਕੀਤੀ ਜਾਂਦੀ ਹੈ ਔਰ ਭਾਰਤ ਦੇ ਵਿੱਚ ਦੂਜੇ ਰਾਜਾਂ ਨਾਲੋਂ ਪੰਜਾਬ ਵਿੱਚ ਬੈਂਕਿੰਗ ਅਤੇ ਬੀਮਾ ਦਾ ਬਹੁਤ ਜਿਆਦਾ ਵਾਧਾ ਹੋ ਗਿਆ ਹੈ